ਮੈਂ ਬਾਲ ਮਜ਼ਦੂਰੀ ਦੇ ਬਹੁਤ ਸਖ਼ਤ ਖਿਲਾਫ ਹਾਂ ਜੀ ਕਿਉਂਕਿ ਇਹੀ ਤਾਂ ਉਮਰ ਹੈ ਬੱਚੇ ਦੇ ਹੱਸਣ ਖੇਡਣ ਦੀ ਉਸਦੇ ਪੜ੍ਹਨ ਲਿਖਣ ਦੀ ਉਸਦੇ ਆਪਣੇ ਜਿਹੜੇ ਆਪਣੇ ਸੁਪਨੇ ਨੇ ਉਹਨਾਂ ਨੂੰ ਬੁਣਨ ਦੀ ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਬੱਚੇ ਨੇ ਜਿਹੜੇ ਉਹ ਮਜ਼ਬੂਰੀ ਦੇ ਵਿੱਚ ਵੀ ਕੰਮ ਕਰਦੇ ਨੇ ਤਾਂ ਸਾਨੂੰ ਚਾਹੀਦਾ ਕਿ ਉਹਨਾਂ ਬੱਚਿਆਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਨੂੰ ਕੁਛ ਖਾਣ ਪੀਣ ਲਈ ਜਾਂ ਉਹਨਾਂ ਨੂੰ ਕੁਛ ਪਹਿਨਣ ਲਈ ਜਾਂ ਘਰ ਦਾ ਰਾਸ਼ਨ ਪਾਣੀ ਕੁਛ ਐਦਾਂ ਦਾ ਦਿੱਤਾ ਜਾ ਸਕਦਾ ਉਹਨਾਂ ਨੂੰ ਸਮਝ ਕੇ ਕਿ ਕੀ ਮਜ਼ਬੂਰੀ ਆ ਕਾਹਤੇ ਉਹ ਕੰਮ ਕਰ ਰਹੇ ਨੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸੰਪਰਕ ਕਰਕੇ ਉਹਨਾਂ ਨਾਲ ਮਿਲ ਵੀ ਸਕਦੇ ਹਾਂ ਉਹਨਾਂ ਦੀ ਆਰਥਿਕ ਮਦਦ ਕਰ ਸਕਦੇ ਹਾਂ ਪੜ੍ਹਾਈ ਦੇ ਵਿੱਚ ਹੈ ਨਾ ਇਸ ਤਰ੍ਹਾਂ ਅਤੇ ਜੇਕਰ ਅਸੀਂ ਨੌਕਰੀਆਂ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਜ਼ਿਆਦਾਤਰ ਟ੍ਰੈਫਿਕ ਲਾਈਟਸ ਦੇ ਉੱਤੇ ਹੀ ਖੜ੍ਹਾ ਖੜ੍ਹਾਇਆ ਜਾਂਦਾ ਕਿ ਜਦੋਂ ਲਾਈਟ ਹੋਈ ਤਾਂ ਬੱਚੇ ਭੱਜ ਭੱਜ ਕੇ ਗੱਡੀਆਂ ਕਾਰਾਂ ਵੱਲ ਮੰਗਣ ਲਈ ਆਉਂਦੇ ਨੇ ਅਤੇ ਉਦੋਂ ਐਕਸੀਡੈਂਟ ਹੋਣ ਦਾ ਵੀ ਖਤਰਾ ਰਹਿੰਦਾ ਬਾਕੀ ਦੂਜਾ ਵੀ ਆਮ ਹੋਟਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਛੋਟੇ ਛੋਟੇ ਬੱਚੇ ਨੇ ਜਿਹੜੇ ਉਹਨਾਂ ਨੂੰ ਬਰਤਨ ਵਗੈਰਾ ਸਾਫ਼ ਕਰਨ ਦੇ ਲਈ ਹੈ ਨਾ ਰੱਖਿਆ ਜਾਂਦਾ ਹਾਂਜੀ ਇਹ ਸਾਰੀਆਂ ਚੀਜ਼ਾਂ ਬਾਲ ਮਜ਼ਦੂਰੀ ਵਿੱਚ ਆ ਜਾਂਦੀਆਂ ਨੇਗੀਆਂ ਇਸ 'ਚ ਇਹ ਸਾਨੂੰ ਸਮਝਣ ਦੀ ਲੋੜ ਆ ਕਿ ਬੱਚੇ ਕਿਉਂ ਕਰ ਰਹੇ ਨੇ ਅਤੇ ਕੀ ਕਾਰਨ ਆ ਉਹਨਾਂ ਦੇ ਅਸੀਂ ਆਰਥਿਕ ਮਦਦ ਆ ਜਿਹੜੀ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਪਰਿਵਾਰ ਵਗੈਰਾ ਨੂੰ ਮਿਲ ਕੇ ਜਾਂ ਕਿਸੇ ਸੰਸਥਾ ਦੇ ਥਰੂ ਉਹਨਾਂ ਦੀ ਜਿਹੜੀ ਮਦਦ ਆ ਉਹ ਅਸੀਂ ਕਰਵਾ ਸਕਦੇ ਹਾਂ